ਸਤਿ ਸ਼੍ਰੀ ਅਕਾਲ ਜੀ ਹਾਂ ਸਾਨੀ ਡਿਪਾਰਟਮੈਂਟਲ ਸਟੋਰ 'ਤੇ ਤੁਹਾਡਾ ਫੋਨ ਕਰਨ ਲਈ ਬਹੁਤ ਬਹੁਤ ਧੰਨਵਾਦ ਮੈਂ ਜਾਣ ਸਕਦਾਂ ਤੁਸੀਂ ਕੀ ਕੌਣ ਹੋ ਅਤੇ ਹਾਂਜੀ ਦੇਖੋ ਜੀ ਸਾਡੇ ਇੱਧਰੋਂ ਦੁੱਧ ਦਾ ਰੇਟ ਸੱਤਰ ਰੁਪਏ ਕਿਲੋ ਆ ਅਤੇ ਚੀਨੀ ਚੀਨੀ ਸਾਡੇ ਕੋਲ ਪੰਤਾਲੀ ਰੁਪਏ ਕਿਲੋ ਆ ਅਤੇ ਚਾਵਲ ਸਾਡੇ ਕੋਲ ਤਿੰਨ ਵਰਾਈਟੀ ਦੇ ਨੇ ਜਿਹਦਾ ਅੱਡ ਅੱਡ ਰੇਟ ਆ ਜੇਕਰ ਤੁਹਾਨੂੰ ਫੁੱਲ ਬਾਸਮਤੀ ਚਾਹੀਦਾ ਫਿਰ ਤਾਂ ਸਾਡੇ ਕੋਲ ਇੱਕ ਸੌ ਵੀਹ ਰੁਪਏ ਵਾਲੇ ਨੇ ਪਰ ਜੇਕਰ ਤੁਹਾਨੂੰ ਘੱਟ ਡਾਈਟ ਵਿੱਚ ਚਾਹੀਦਾ ਤਾਂ ਉਹਦੇ ਪਝੱਤਰ ਰੁਪਏ ਨੇ ਅਤੇ ਅਗਰ ਤੁਹਾਨੂੰ ਲੋਅ ਕੁਆਲਿਟੀ ਵਾਲੇ ਚਾਵਲ ਚਾਹੀਦੇ ਨੇ ਤਾਂ ਉਹਦਾ ਰੇਟ ਪਝੱਤਰ ਰੁਪਏ ਬਾਸਮਤੀ ਦੇ ਓਕੇ ਜੀ ਉਹਦੇ ਇੱਕ ਸੌ ਵੀਹ ਰੇਟ ਆ ਵੈਸੇ ਤਾਂ ਮੈਮ ਸਾਡੇ ਕੰਪਨੀ ਵੱਲੋਂ ਸਾਰਿਆਂ ਨੂੰ ਹੀ ਦਸ ਪ੍ਰਸੈਂਟ ਡਿਸਕਾਊਂਟ ਦਿੱਤਾ ਜਾਂਦਾ ਪਰ ਅਗਰ ਤੁਸੀਂ ਇਮੀਡੀਏਟ ਪੇਮੈਂਟ ਕਰਦੇ ਓਂ ਤਾਂ ਅਸੀਂ ਤੁਹਾਨੂੰ ਦਸ ਪ੍ਰਸੈਂਟ ਹੋਰ ਡਿਸਕਾਊਂਟ ਦੇ ਦਾਂਗੇ ਜਿਹਦੇ ਨਾਲ ਤੁਹਾਨੂੰ ਓਕੇ ਮੈਮ ਨਹੀਂ ਮੈਮ ਸਾਨੂੰ ਇਸ ਤੋਂ ਵੱਧ ਨਹੀਂ ਪੈਂਦਾ ਐਕਚੁਲੀ ਗਰੀਬ ਲੋਕ ਹਾਂ ਅਸੀਂ ਤੁਹਾਨੂੰ ਪਤਾ ਹੀ ਹੈ ਦੁੱਧ ਸਪਲਾਈ ਕਰਨਾ ਫਿਰ ਉਸ ਤੋਂ ਬਾਅਦ ਰੋਡ ਟੈਕਸ ਕਿੰਨਾ ਕੁ ਪੈਂਦਾ

ਘਰੇ ਉਪਲਬਧ ਹੋਜੂਗਾ ਮੈਮ ਲੇਕਿਨ ਤੁਹਾਨੂੰ ਉਹਦੇ ਲਈ ਐਕਸਟਰਾ ਚਾਰਜ ਕਰਨਾ ਪਊ ਮੈਮ ਤੁਹਾਨੂੰ ਡੇਢ ਸੌ ਰੁਪਏ ਐਕਸਟਰਾ ਚਾਰਜ ਕਰਨੇ ਪੈਣਗੇ ਮੈਮ ਤੁਹਾਨੂੰ ਪਤਾ ਹੀ ਹੈ ਪੈਟਰੋਲ ਦੇ ਰਾ ਰੇਟ ਕੀ ਨੇ ਅਤੇ ਸਾਨੂੰ ਅੱਗੇ ਸਾਨੂੰ ਕੁਝ ਬਚਦਾ ਹੀ ਨਹੀਂ

ਤੁਸੀਂ ਮੈਨੂੰ ਆਪਣਾ ਐਡਰੈਸ ਭੇਜ ਦਿਓ ਤੁਸੀਂ ਅਰਬਨ ਸਟੇਟ ਰਹਿੰਦੇ ਓਂ ਓਕੇ ਮੈਮ ਤੁਹਾਨੂੰ ਇਹ ਸਮਾਨ ਵੀਹ ਤੋਂ ਪੱਚੀ ਮਿੰਟ ਦੇ ਵਿੱਚ ਵਿੱਚ ਡਿਲੀਵਰ ਹੋਜੂਗਾ ਜੀ ਮੈਮ ਜੇਕਰ ਤੁਸੀਂ ਕੈਸ਼ ਪੇ ਕਰਦੇ ਓਂ ਫਿਰ ਤਾਂ ਤੁਹਾਨੂੰ ਡਿਸਕਾਊਂਟ ਹੈ ਲੇਕਿਨ ਜਿਵੇਂ ਹੀ ਔਡਰ ਸਬਮਿਟ ਹੁੰਦਾ ਉਵੇਂ ਹੀ ਤੁਸੀਂ ਇਹ ਸਾਨੂੰ ਅਗਰ ਜੀ ਪੇ ਕਰਦੇ ਓਂ ਅਗਰ ਤੁਸੀਂ ਰੀਸੈਂਟਲੀ ਪੇ ਕਰਦੇ ਓਂ ਤਾਂ ਤੁਹਾਨੂੰ ਪੰਜ ਪ੍ਰਸੈਂਟ ਡਿਸਕਾਊਂਟ ਮਿਲੇਗਾ ਓਕੇ ਮੈਮ ਫਿਰ ਤੁਹਾਨੂੰ ਤੁਹਾਡੇ ਲਈ ਸਿਰਫ ਟੈਨ ਪ੍ਰਸੈਂਟ ਡਿਸਕਾਊਂਟ ਆ ਓਕੇ ਜੀ ਥੈਂਕ ਯੂ ਮੈਮ